ਪਹਿਲਾਂ ਮੈਂ ਐਕਸਪੈਰੀਮੈਂਟ ਕਰਦਾ ਹਾਂ ਅਤੇ ਉਸ ਨੂੰ ਆਪਣੀ ਸੋਚ ਨਾਲ਼ ਮਿਲਾ ਕੇ ਚਿੱਤਰਕਾਰੀ ਕਰਦਾ ਹਾਂ ਅਤੇ ਸਰੁੰਤ ਸੰਤੁਲਿਤ ਕਰਦਾ